ਇੱਕ ਨਿੱਜੀ ਯਾਤਰੀ ਬੱਸ ਬਹੁਤ ਹੀ ਵਧੀਆ ਹੁੰਦੀ ਹੈ ਅਸੀਂ ਜਦੋਂ ਵੀ ਆਪਣੇ ਪਰਿਵਾਰ ਸਹਿਤ ਜਾਂ ਯਾਰਾਂ ਮਿੱਤਰਾਂ ਨਾਲ ਸਫਰ ਕਰਨਾ ਹੋਵੇ ਤਾਂ ਅਸੀਂ ਇੱਕ ਯਾਤਰੀ ਬੱਸ ਨਿੱਜੀ ਤੌਰ 'ਤੇ ਬੁੱਕ ਕਰ ਲੈਂਦੇ ਹਾਂ ਇਸ ਯਾਤਰੀ ਬੱਸ ਵਿੱਚ ਪੰਦਰਾਂ ਤੋਂ ਲੈ ਕੇ ਸੋਲਾਂ ਸਵਾਰੀਆਂ ਤੱਕ ਬੈਠ ਸਕਦੀਆਂ ਹਨ ਪਿਛਲੀ ਦਫਾ ਅਸੀਂ ਸ਼੍ਰੀ ਵਰਿੰਦਾਵਨ ਦਾ ਪ੍ਰੋਗਰਾਮ ਬਣਾਇਆ ਸੀ ਜਿਸ ਵਿਸ ਵਿੱਚ ਅਸੀਂ ਇੱਕ ਯਾਤਰੀ ਬੱਸ ਬੁੱਕ ਕੀਤੀ ਇਸ ਦੀਆਂ ਸੀਟਾਂ ਬਹੁਤ ਹੀ ਆਰਾਮਦਾਇਕ ਹੁੰਦੀਆਂ ਹਨ ਜਿਸ 'ਤੇ ਬੈਠ ਕੇ ਸਾਨੂੰ ਥਕਾਵਟ ਕਦੇ ਵੀ ਮਹਿਸੂਸ ਨਹੀਂ ਹੋਈ ਇਸ ਯਾਤਰੀ ਬੱਸ ਵਿੱਚ ਸਟੋਰੇਜ ਦੀ ਵੀ ਕਪੈਸਿਟੀ ਬਹੁਤ ਜ਼ਿਆਦਾ ਹੁੰਦੀ ਹੈ ਸਾਈਡ 'ਤੇ ਇੱਕ ਡਿੱਕੀ ਬਣੀ ਹੋਈ ਹੈ ਜਿਸ ਵਿੱਚ ਅਸੀਂ ਕਿੰਨੇ ਸਾਰੇ ਬੈਗ ਲਗੇਜ ਵਗੈਰਾ ਰੱਖ ਲੈਂਦੇ ਹਾਂ ਅਤੇ ਸਾਨੂੰ ਦਿੱਕਤ ਕੋਈ ਵੀ ਨਹੀਂ ਆਉਂਦੀ ਇੱਕ ਟੋਪ 'ਤੇ ਵੀ ਕੈਰੀਅਰ ਲੱਗਾ ਹੋਇਆ ਹੈ ਜਿਸ ਵਿੱਚ ਅਸੀਂ ਵਰਤਣ ਵਾਲਾ ਸਮਾਨ ਵੀ ਰੱਖ ਲੈਂਦੇ ਹਾਂ ਇਸ ਦੀਆਂ ਵਿੰਡੋਜ ਵੀ ਬਹੁ ਬਹੁਤ ਵਧੀਆ ਹੈ ਸਾਈਡ 'ਤੇ ਲੱਗੀਆਂ ਹੋਈਆਂ ਹਨ ਸ਼ਟਰ ਅਪ ਜਾਂ ਡਾਊਨ ਕਰ ਸਕਦੇ ਹਾਂ ਉਸਦਾ ਜਿਸ ਨਾਲ ਹਵਾਦਾਇਕ ਵਿੰਡੋਸ ਹੈ ਵਿੰਡੋਸ ਦੇ ਅੱਗੇ ਪਰਦਾ ਵੀ ਲੱਗਾ ਹੋਇਆ ਜੇ ਧੁੱਪ ਵਗੈਰਾ ਜਾਂ ਚਾਨਣ ਆਉਂਦਾ ਹੋਵੇ ਤਾਂ ਪਰਦਾ ਅੱਗੇ ਕਰ ਲਈ ਦਾ ਹੈ ਜਿਸ ਨਾਲ ਅਸੀਂ ਅੱਖਾਂ ਬੰਦ ਮੁੰਦ ਕੇ ਅਰਾਮ ਵੀ ਕਰ ਸਕਦੇ ਹਾਂ ਫਿਰ ਡੀਜ਼ਲ 'ਤੇ ਚੱਲਣ ਵਾਲੀਆਂ ਸਾਨੂੰ ਘੱਟ ਡੀਜ਼ਲ 'ਤੇ ਜ਼ਿਆਦਾ ਸਫਰ ਵੀ ਤੈਅ ਕਰਵਾ ਦਿੰਦੀਆਂ ਹਨ ਡਰਾਈਵਰ ਵੀ ਨੇ ਵੀ ਕਈ ਵਾਰੀ ਸੀਟ ਦੀ ਤਾਰੀਫ ਕੀਤੀ ਹੈ ਕਿ ਉਸਨੂੰ ਵੀ ਡਰਾਈਵਿੰਗ ਕਰਦੇ ਹੋਏ ਕਦੇ ਵੀ ਥਕਾਵਟ ਮਹਿਸੂਸ ਨਹੀਂ ਹੋਈ ਇਸ ਲਈ ਅਸੀਂ ਜਦੋਂ ਵੀ ਕਿਤੇ ਵੀ ਜਾਣਾ ਹੋਵੇ ਤਾਂ ਨਿੱਜੀ ਤੌਰ 'ਤੇ ਯਾਤਰੀ ਬੱਸ ਬੁੱਕ ਕਰ ਲਈ ਦੀ ਹੈ ਕਿਉਂਕਿ ਇਹ ਇੰਨੀ ਕੁ ਕੰਫਰਟੇਬਲ ਹੁੰਦੀ ਹੈ ਇੰਨੀ ਕੁ ਆਰਾਮਦਾਇਕ ਹੁੰਦੀ ਹੈ ਕਿ ਸਾਨੂੰ ਜ਼ਿਆਦਾ ਸਫਰ ਵੀ ਬਹੁਤ ਜਲਦੀ ਛੇਤੀ ਸਮੇਂ ਨਾਲ ਪ ਪੂਰਾ ਕਰਾ ਦਿੰਦੀ ਹੈ ਅਤੇ ਉਹ ਵੀ ਥਕਾਵਟ ਤੋਂ ਬਗੈਰ ਧੰਨਵਾਦ